ਭੰਗੜੇ ਦੇ ਪ੍ਰਦਰਸ਼ਨ ਲਈ ਸਭ ਤੋਂ ਜਿਆਦਾ ਚਮਕੀਲੇ ਅਤੇ ਵੱਖ ਵੱਖ ਰੰਗ ਦੇ ਪਹਿਨਾਵੇ ਦੀ ਜਰੂਰਤ ਹੁੰਦੀ ਹੈ ਜਿਸ ਵਿੱਚ ਪੰਜਾਬੀ ਕੁੜਤਾ ਚਾਦਰਾ ਫੁੱਲਾਂ ਵਾਲੇ ਡਿਜਾਇਨ ਵਾਲੀ ਜਾਕਟ ਤੇ ਗਲ ਵਿੱਚ ਕੈਂਠਾ ਜਾਂ ਮੋਤੀਆਂ ਵਾਲਾ ਹਾਰ ਹੁੰਦਾ ਹੈ ਇਸ ਤੋਂ ਇਲਾਵਾ ਸਿਰ ਉੱਪਰ ਪਗੜੀ ਦਾ ਹੋਣਾ ਵੀ ਬਹੁਤ ਜਰੂਰੀ ਹੁੰਦਾ ਹੈ ਭੰਗੜੇ ਲਈ ਪਹਿਰਾਵੇ ਵਿਸ਼ੇਸ਼ ਤਰ੍ਹਾਂ ਨਾਲ ਪੱਗ ਵੀ ਸਜਾਈ ਜਾਂਦੀ ਹੈ ਜਿਸ ਉੱਪਰ ਤੁਰਲਾ ਜੋ ਕਿ ਗਰਦਨ ਦੇ ਪਿੱਛੇ ਛੱਡਿਆ ਹੁੰਦਾ ਹੈ ਅਤੇ ਫਰਲਾ ਜੋ ਵਿਸ਼ੇਸ਼ ਪ੍ਰਕਾਰ ਦੇ ਕੱਪੜੇ ਨੂੰ ਮਾਵਾ ਲਗਾ ਕੇ ਤਿਆਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਪੱਗ ਉੱਪਰ ਰੰਗਦਾਰ ਪੱਟੀ ਵੀ ਬੰਨੀ ਜਾਂਦੀ ਹੈ ਭੰਗੜੇ ਦੀ ਟੀਮ ਦੇ ਵੱਖਰੇ ਵੱਖਰੇ ਰੰਗਾਂ ਦੀ ਪੁਸ਼ਾਕ ਪਾਈ ਜਾਂਦੀ ਹੈ ਜੋ ਕਿ ਰੰਗ ਬਿਰੰਗੀ ਫੁਲਵਾੜੀ ਦੀ ਤਰ੍ਹਾ ਲੱਗਦੀ ਹੈ ਇਸ ਤੋਂ ਇਲਾਵਾ ਪਿੱਤਲ ਦੇ ਕੋਕਿਆਂ ਵਾਲੀ ਡਾਂਗ ਤੇ ਨੋਕਦਾਰ ਤਿੱਲੇ ਵਾਲੀ ਜੁੱਤੀ ਪਾਈ ਜਾਂਦੀ ਹੈ ਕਿਸੇ ਵੀ ਤਿਉਹਾਰ ਜਿਵੇਂ ਕਿ ਵਿਸਾਖੀ ਜਾਂ ਖੁਸ਼ੀ ਦਾ ਮਾਹੌਲ ਜਿਵੇਂ ਵਿਆਹ ਵਾਲੇ ਦਿਨ ਬੱਚੇ ਜਵਾਨ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ ਅੱਜ ਕੱਲ ਤਾਂ ਵਿਦੇਸ਼ਾਂ ਵਿੱਚ ਵੀ ਭੰਗੜੇ ਦਾ ਬਹੁਤ ਚਰਚਾ ਹੈ ਜਿੱਥੇ ਜਿੱਥੇ ਵੀ ਪੰਜਾਬੀ ਵਸਦੇ ਹਨ ਉਥੇ ਉਥੇ ਭੰਗੜੇ ਨੂੰ ਉਹਨਾਂ ਨੇ ਸੱਭਿਆਚਾਰ ਦਾ ਮੁੱਖ ਅੰਗ ਬਣਾ ਦਿੱਤਾ ਹੈ ਭੰਗੜੇ ਦੇ ਕੁੱਲ ਸਟੈਪ ਹਨ ਜਿਵੇਂ ਕਿ ਜੁਗਨੀ ਝੂਮਰ ਕਲੈਰੀਆ ਟੱਪਾ ਧਮਾਲ ਲੁੱਡੀ ਢੋਲ ਸੰਮੀ ਆਦਿ ਮਲਵਈ ਗਿੱਧਾ ਵੀ ਭੰਗੜੇ ਦਾ ਇਕ ਪ੍ਰਚਲਤ ਰੂਪ ਹੈ ਜਿਸ ਨੂੰ ਅੱਜ ਕੱਲ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਵਿੱਚ ਬਹੁਤ ਲਿਜਾਅ ਇਸ ਵਿੱਚ ਸੱਪ ਕਾਟੋ ਭੁਗਚੂ ਚਿਮਟੇ ਆਦਿ ਦੀ ਵਰਤੋਂ ਕਰਕੇ ਭੰਗੜੇ ਨੂੰ ਬੋਲੀਆਂ ਨਾਲ ਰਲਾ ਕੇ ਹੋਰ ਸੋਹਣਾ ਕਰ ਦਿੱਤਾ ਗਿਆ ਹੈ ਇਸ ਨੂੰ ਜਦੋਂ ਪਾਇਆ ਜਾਂਦਾ ਹੈ ਤਾਂ ਮਾਹੌਲ ਬਣ ਜਾਂਦਾ ਹੈ ਲੋਕਾਂ ਦਾ ਮੱਲੋ ਮੱਲੀ ਨੱਚਣੇ ਨੂੰ ਜੀਅ ਕਰਦਾ ਹੈ ਇਸੇ ਕਰਕੇ ਹੀ ਇਸ ਨੂੰ ਸੱਭਿਆਚਾਰ ਦਾ ਇਹ ਜਿਹਾ ਅੰਗ ਮੰਨਿਆ ਗਿਆ ਹੈ ਜੋ ਕਿ ਪੰਜਾਬ ਨਾਲੋਂ ਅਲੱਗ ਨਹੀਂ ਹੋ ਸਕਦਾ ਤਾਂ ਹੀ ਤਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਇਸਦੇ ਪ੍ਰੋਗਰਾਮ ਵੀ ਕਰਾਏ ਜਾਂਦੇ ਹਨ ਅਤੇ ਬੱਚਿਆਂ ਨੂੰ ਹਿੱਸਾ ਲਿਆ ਦਵਾਇਆ ਜਾਂਦਾ ਹੈ ਜਿਸ ਨਾਲ ਕਿ ਉਹਨਾਂ ਵਿੱਚ ਇਹ ਹਮੇਸ਼ਾ ਲਈ ਵੱਸ ਜਾਵੇ